ਅੱਜ ਕੱਲ੍ਹ ਦੇ ਸਮੇਂ ਵਿੱਚ ਫ਼ੋਨ ਅਤੇ ਲੈਪਟੋਪ ਨੇ ਬਹੁਤ ਜ਼ਿਆਦਾ ਹੀ ਸੌਖਾ ਕੰਮ ਕਰ ਦਿੱਤਾ ਹੈ ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਸਾਰਾ ਕੰਮ ਲੈਪਟੋਪ ਅਤੇ ਫ਼ੋਨਾਂ ਉੱਪਰ ਹੀ ਹੁੰਦਾ ਹੈ ਅਤੇ ਮੇਰਾ ਕੋਲਿਜ ਦਾ ਕੰਮ ਸਾਰਾ ਫ਼ੋਨ ਉੱਪਰ ਆਉਂਦਾ ਹੈ ਅਤੇ ਕੱਲ੍ਹ ਮੇਰਾ ਫ਼ੋਨ ਖਰਾਬ ਹੋ ਗਿਆ ਪਰ ਮੈਨੂੰ ਬਹੁਤ ਮੁਸੀਬਤ ਆਈ ਪਰ ਮੈਂ ਕੀ ਕੀਤਾ ਪਰ ਮੈਂ ਗਿਆ ਅਤੇ ਫ਼ੋਨ ਸੈੱਟ ਕਰਵਾਉਣ ਅਤੇ ਮੈਂ ਉਸ ਕੋਲੋਂ ਪੁੱਛਿਆ ਵੀ ਇਸ ਫ਼ੋਨ ਨੂੰ ਕੀ ਹੋਇਆ ਹੈ ਪਰ ਉਸਨੇ ਮੈਨੂੰ ਦੱਸਿਆ ਵੀ ਇਸ ਫ਼ੋਨ ਦੀ ਡਿਸਪਲੇਅ ਉੜ ਗਈ ਹੈ ਅਤੇ ਉਸਨੇ ਮੈਨੂੰ ਕਿਹਾ ਵੀ ਇਸ ਫ਼ੋਨ ਦੀ ਡਿਸਪਲੇਅ ਪੰਦਰ੍ਹਾਂ ਸੌ ਰੁਪਏ ਦੀ ਹੈ ਪਰ ਮੈਂ ਕਿਹਾ ਵੀ ਤੁਸੀਂ ਚਲੋ ਪਾ ਦਿਓ ਵੀ ਮੈਨੂੰ ਬਹੁਤ ਮੁਸੀਬਤ ਹੈ ਪਰ ਮੈਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਪਰ ਮੈਂ ਉਸਦੀ ਡਿਸਪਲੇਅ ਪਵਾ ਕੇ ਚਲੋ ਮੇਰਾ ਕੰਮ ਸਰ ਗਿਆ ਵੀ ਉਸਨੇ ਡਿਸਪਲੇਅ ਦੋ ਦਿਨ ਵਿੱਚ ਹੀ ਪਾ ਦਿੱਤੀ ਪਰ ਮੈਂ ਦੋ ਦਿਨਾਂ ਵਿੱਚ ਹੀ ਬਹੁਤ ਜ਼ਿਆਦਾ ਪਿੱਛੇ ਰਹਿ ਗਿਆ ਮੇਰਾ ਕੋਲਿਜ ਦਾ ਕੰਮ